ਜੇ ਪ੍ਰੈਸ ਦੀ ਆਜ਼ਾਦੀ ਦੀ ਗੱਲ ਕੀਤੀ ਜਾਵੇ ਤਾਂ ਮੈਂ ਬਿਨਾਂ ਕਿਸੇ ਸੰਕੋਚ ਜਾਂ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਦਾ ਸਾਰਾ ਤਾਂ ਨਹੀਂ ਬਟ ਬਹੁਤ ਜ਼ਿਆਦਾ ਨਿਊਜ਼ ਚੈਨਲ ਨਿਊਜ਼ ਪੇਪਰ ਸਰਕਾਰ ਦੁਆਰਾ ਨਿਯੰਤਰਨ ਕੀਤੇ ਜਾ ਰਹੇ ਨੇ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਉਹ ਸਟੇਟ ਤੋਂ ਹੈ ਸਰਕਾਰ ਨੂੰ ਜੋ ਖਬਰ ਜਿਵੇਂ ਪਸੰਦ ਹੈ ਉਵੇਂ ਹੀ ਪੇਸ਼ ਕੀਤੀ ਜਾਂਦੀ ਆ ਖਬਰ ਨੂੰ ਹੂਬਹੂ ਲੋਕਾਂ ਦੁਆਰਾ ਨਹੀਂ ਪਹੁੰਚਾਇਆ ਜਾਂਦਾ ਉਸਦੇ ਵਿੱਚ ਮੈਨੁਪੁਲੇਸ਼ਨ ਕੀਤਾ ਜਾਂਦਾ ਕੁਛ ਨਾ ਕੁਛ ਮਿਲਾਵਟ ਕੀਤੀ ਹੀ ਜਾਂਦੀ ਹੈ ਸਾਡਾ ਮੀਡੀਆ ਬਹੁਤ ਸਾਡੇ ਦੇਸ਼ ਦੀ ਤਰਾਸਦੀ ਆ ਵੀ ਜ਼ਿਆਦਾਤਰ ਇਹ ਵਿਕਾਊ ਹੀ ਆ ਅਤੇ ਲੋਕਾਂ ਤੱਕ ਸਹੀ ਖਬਰ ਸਹੀ ਟਾਈਮ 'ਤੇ ਸਹੀ ਤੱਤਾਂ ਸਹੀ ਫੈਕਟਾਂ ਨਾਲ ਨਹੀਂ ਪਹੁੰਚਾਈ ਜਾਂਦੀ ਲੋਕਾਂ ਨੂੰ ਕਨਫਿਊਜ਼ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਡਾਊਟ ਕ੍ਰੀਏਟ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ